ਪਿੰਡ ਵਿੱਚ ਸਾਨੂੰ ਘਰ ਬਣਾਉਣ ਵੇਲੇ ਸਭ ਤੋਂ ਪਹਿਲਾਂ ਜਗ੍ਹਾ ਦੇਖਣੀ ਚਾਹੀਦੀ ਹੈ ਕਿ ਸਾਡੀ ਜਗ੍ਹਾ ਕਿਸ ਤਰ੍ਹਾਂ ਦੀ ਹੈ ਉਹ ਗਊ ਮੁਖੀ ਹੈ ਜਾਂ ਸ਼ੇਰ ਮੂਖੀ ਹੈ ਕਿਉਂਕਿ ਗਊ ਮੂਖੀ ਜਗ੍ਹਾ ਜਿਹੜੀ ਉਹ ਘਰ ਬਣਾਉਣ ਦੇ ਲਈ ਬਿਹਤਰ ਮੰਨੀ ਜਾ ਸਕਦੀ ਹੈ ਜੇਕਰ ਸਾਡੀ ਜਗ੍ਹਾ ਚੌਰਸ ਹੈ ਤਾਂ ਫਿਰ ਤਾਂ ਬਹੁਤ ਹੀ ਵਧੀਆ ਦੂਸਰੀ ਗੱਲ ਇਹ ਕਿ ਆਪਣੇ ਬਜਟ ਨੂੰ ਲੈ ਕੇ ਵੀ ਸਾਨੂੰ ਆਪਣੇ ਮਕਾਨ ਦਾ ਨਕਸ਼ਾ ਤਿਆਰ ਕਰਾਉਣਾ ਚਾਹੀਦਾ ਹੈ ਕਿ ਸਾਡਾ ਬਜਟ ਕਿੰਨਾ ਕੁ ਹੈ ਮਕਾਨ ਦੀ ਉਸਾਰੀ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਵੀ ਕਰਨੀ ਚਾਹੀਦੀ ਹੈ ਸਰਦੀ ਗਰਮੀ ਮੌਸਮ ਪੰਜਾਬ 'ਚ ਦੋਵੇਂ ਪੱਤਝੜ ਬਸੰਤ ਮਤਲਬ ਜਿਸ ਤਰ੍ਹਾਂ ਜੋ ਵੀ ਹਾਂਜੀ ਜੇਕਰ ਅਸੀਂ ਕੋਈ ਕਿੱਤਾ ਕਰਦੇ ਹਾਂ ਤਾਂ ਸਾਨੂੰ ਆਪਣੀ ਦੁਕਾਨਾਂ ਦੀ ਦੀ ਵੀ ਜਗ੍ਹਾ ਰੱਖਣੀ ਚਾਹੀਦੀ ਹੈ ਕਿਉਂਕਿ ਉਹ ਸਾਡੇ ਆਮਦਨ ਦਾ ਸਰੋਤ ਕਰ ਸਕਦੀ ਹੈ ਪੂਜਾ ਸਥਾਨ ਘਰ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਪੰਜਾਬੀ ਲੋਕ ਬਹੁਤ ਹੀ ਆਸਤਿਕ ਹੁੰਦੇ ਹਾਂ ਬਾਥਰੂਮ ਕਦੇ ਵੀ ਰਸੋਈ ਦੇ ਨਾਲ ਨਹੀਂ ਹੋਣਾ ਚਾਹੀਦਾ ਇਕ ਖੁੱਲ੍ਹੀ ਜਗ੍ਹਾ 'ਤੇ ਸਾਡੇ ਰਿਹਾਇਸ਼ੀ ਕਮਰਿਆਂ ਤੋਂ ਦੂਰ ਹੋਣਾ ਚਾਹੀਦਾ ਹੈ ਅਤੇ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਉਹਨਾਂ ਨੇ ਇੱਕ ਆਵਾਸ ਯੋਜਨਾ ਜਾਂ ਘਰ ਕੁਲ ਯੋਜਨਾ ਜੋੋ ਕਿ ਦੱਸਿਆ ਗਿਆ ਹੈ ਉਸ ਨੂੰ ਚਲਾਇਆ ਹੈ ਤਾਂ ਜੋ ਹਰ ਇਕ ਇਨਸਾਨ ਆਪਣਾ ਘਰ ਬਣਾ ਸਕੇ ਇਸ ਸਕੀਮ ਦੇ ਤਹਿਤ ਉਹ ਜੀਰੋ ਪਰਸੈਂਟ ਵਿਆਜ 'ਤੇ ਲੋਕਾਂ ਨੂੰ ਲੋਨ ਦਿੰਦੇ ਹਨ ਅਤੇ ਕਿਉਂਕਿ ਉਹ ਹ ਅ ਹਰ ਇੱਕ ਕੋਈ ਅਮੀਰ ਗਰੀਬ ਆਪਣਾ ਘਰ ਬਣਾ ਸਕੇ ਕਿਉਂਕਿ ਹਰੇਕ ਸਿਰ 'ਤੇ ਛੱਤ ਜ਼ਰੂਰੀ ਹੈ ਬਾਕੀ ਰੋਟੀ ਕੱਪੜਾ ਅਤੇ ਮਕਾਨ ਸਭ ਦੀ ਮੁੱਢਲੀ ਜ਼ਰੂਰਤ ਹੈ